ਮੇਰੇ ਅਨੁਸਾਰ ਤੈਰਾਕੀ ਸਿੱਖਣ ਲਈ ਉਸ ਜਗ੍ਹਾ 'ਤੇ ਜਾਣਾ ਚਾਹੀਦਾ ਜਿੱਥੇ ਚੰਗਾ ਕੋਚ ਹੋਵੇ ਅਤੇ ਨਾਲ ਸਿੱਖਣ ਵਾਲੇ ਵੀ ਕੁਝ ਵਿਅਕਤੀ ਹੋਣੇ ਚਾਹੀਦੇ ਨੇ ਤਲਾਅ ਜ਼ਿਆਦਾ ਡੂੰਘਾ ਨਾ ਹੋਵੇ ਤਲਾਅ ਸਾਫ ਸੁਥਰਾ ਅਤੇ ਹਵਾਦਾਰ ਹੋਣਾ ਚਾਹੀਦਾ ਪਾਣੀ ਦਾ ਸਾਫ ਹੋਣਾ ਵੀ ਬਹੁਤ ਜ਼ਰੂਰੀ ਹੈ ਅਤੇ ਉਸ ਦਾ ਤਾਪਮਾਨ ਵੀ ਮੌਸਮ ਦੇ ਅਨੁਸਾਰ ਹੋਣਾ ਚਾਹੀਦਾ ਗੁਸਲਖਾਨੇ ਵੀ ਸਾਫ ਅਤੇ ਰੋਸ਼ਨ ਹੋਣੇ ਚਾਹੀਦੇ ਨੇ ਤਲਾਅ 'ਤੇ ਬਚਾਉ ਸਹਾਇਕ ਪਾਈਪ ਅਤੇ ਪੌੜੀਆਂ ਲੱਗੀਆਂ ਹੋਣੀਆਂ ਜ਼ਰੂਰੀ ਨੇ ਤਲਾਅ ਦੀਆ ਟਾਈਲਾਂ ਬਿਲਕੁਲ ਸਮਤਲ ਹੋਣੀਆਂ ਚਾਹੀਦੀਆਂ ਨੇ ਉਸ ਦੇ ਨਾਲ ਕਈ ਵਾਰੀ ਸਰੀਰ 'ਤੇ ਸੱਟ ਲੱਗ ਜਾਂਦੀ ਹੈ ਨਵੇਂ ਤੈਰਾਕ ਨੂੰ ਹਮੇਸ਼ਾ ਕਿਸੇ ਤਜ਼ਰਬੇਕਾਰ ਦੀ ਨਿਗਰਾਨੀ ਹੇਠ ਹੀ ਤੈਰਾਕੀ ਕਰਨੀ ਚਾਹੀਦੀ ਹੈ ਉਸ ਨੂੰ ਕਦੇ ਵੀ ਨਹਿਰ ਦਰਿਆ ਸਮੁੰਦਰ ਮਤਲਬ ਕਿ ਚੱਲਦੇ ਪਾਣੀ 'ਚ ਤੈਰਾਕੀ ਨਹੀਂ ਕਰਨੀ ਚਾਹੀਦੀ ਇਸ ਚੀਜ਼ ਤੋਂ ਉਸ ਨੂੰ ਗੁਰੇਜ ਕਰਨਾ ਚਾਹੀਦਾ ਸੂਏ ਟੋਬੇ 'ਤੇ ਕਦੇ ਵੀ ਤੈਰਾਕੀ ਨਹੀਂ ਕਰਨੀ ਚਾਹੀਦੀ ਕਿਉਂਕਿ ਪਾਣੀ ਇਹ ਗੰਦਾ ਹੁੰਦਾ ਆ ਤੈਰਾਕੀ ਸਿੱਖਣ ਵਾਲੀ ਜਗ੍ਹਾ 'ਤੇ ਕਦੇ ਵੀ ਇਕੱਲਿਆਂ ਤੈਰਾਕੀ ਨਹੀਂ ਕਰਨੀ ਚਾਹੀਦੀ ਪਾਣੀ 'ਚ ਛਾਲ ਮਾਰਨ ਤੋਂ ਪਹਿਲਾਂ ਉੱਥੋਂ ਦੀ ਡੁੰਘਾਈ ਬਾਰੇ ਪਤਾ ਹੋਣਾ ਜ਼ਰੂਰੀ ਆ